ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ ਅਸੀਂ ਭਾਰਤ ਵਿੱਚ ਇੱਕ ਕੋਨੇ ਦੇ ਵਿੱਚ ਰਹਿੰਦੇ ਹਨ ਪਰ ਭਾਰਤ ਵਿੱਚ ਪਹਾੜ ਨਦੀਆਂ ਅਜਿਹੀਆਂ ਚੀਜ਼ਾਂ ਹਨ ਜਿਹੜੀ ਭਾਰਤ ਦੀ ਖੂਬਸੂਰਤੀ ਹੋਰ ਵਧਾਉਂਦੀ ਹੈ ਜੇ ਅਸੀਂ ਇਹਦੇ ਵਿੱਚ ਗੱਲ ਕਰੀਏ ਅਤੇ ਭਾਰਤ ਦੀ ਫੋਟੋ ਖਿੱਚੀਏ ਤਾਂ ਭਾਰਤ ਨੂੰ ਸਿਰਫ਼ ਇੱਕ ਫੋਟੋ ਦੇ ਨਾਲ ਅਸੀਂ ਨਹੀਂ ਦਰਸ਼ਾ ਸਕਦੇ ਭਾਰਤ ਇੰਨਾ ਵੱਡਾ ਹੈ ਅਤੇ ਇੰਨਾ ਖੂਬਸੂਰਤ ਹੈ ਜਿਹਦੇ ਕੀ ਸਾਨੂੰ ਦਸ ਤੋਂ ਪੰਦਰ੍ਹਾਂ ਫੋਟੋ ਲੱਗਣਗੀਆਂ ਪਰ ਫਿਰ ਵੀ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਭਾਰਤ ਦੀ ਸੈਟਲਾਈਟ ਫੋਟੋ ਖਿਚਾਂਗਾ ਜਿਸ ਵਿੱਚ ਅਸੀਂ ਛੋਟੇ ਬੱਚਿਆਂ ਨੂੰ ਇਹ ਦੱਸ ਸਕਦੇ ਹਨ ਕਿ ਉੱਤੋਂ ਸਾਡੀ ਧਰਤੀ ਤੋਂ ਭਾਰਤ ਕਿਵੇਂ ਦਾ ਲੱਗਦਾ ਹੈ ਭਾਰਤ ਇੱਕ ਖੂਬਸੂਰਤ ਦੇਸ਼ ਹੈ ਅਤੇ ਮੈਂ ਅਲੱਗ ਅਲੱਗ ਫੋਟੋਆਂ ਜ਼ਰੂਰ ਦਰਸ਼ਾਵਾਂਗਾ ਜਿਵੇਂ ਕਿ ਪਹਾੜਾਂ ਦੀ ਫੋਟੋ ਜਿਵੇਂ ਕਿ ਨਦੀਆਂ ਦੀ ਫੋਟੋ ਪਿੰਡ ਅਤੇ ਇੱਥੇ ਗਲੀਆਂ ਵਿੱਚ ਖੇਡਦੇ ਬੱਚਿਆਂ ਦੀ ਅਤੇ ਇਹਦੇ ਨਾਲ ਦੇ ਨਾਲ ਹੀ ਹੋਰ ਮੈਂ ਇਹ ਦੱਸਾਂਗਾ ਕਿ ਭਾਰਤ ਵਿੱਚ ਲੋਕ ਕਿੰਨੇ ਖੁਸ਼ ਰਹਿੰਦੇ ਹਨ